ਪੰਜਾਬ ਵਿੱਚ ਵੱਖ ਵੱਖ ਸਮੇਂ 'ਤੇ ਖੇਡਾਂ ਦਾ ਮਹੱਤਵ ਵੱਧਦਾ ਘੱਟਦਾ ਰਹਿੰਦਾ ਹੈ ਪਰ ਪੇਂਡੂ ਖੇਡਾਂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਵਿੱਚ ਫ਼ਰਕ ਹੈ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਖੇਡਾਂ ਉਹਨਾਂ ਮਨੋਰੰਜਨ ਕਰਨ ਲਈ ਆਪਣੀ ਸਿਹਤ ਨੂੰ ਵਧੀਆ ਬਣਾਉਣ ਲਈ ਤੰਦਰੁਸਤ ਰੱਖਣ ਲਈ ਖੇਡੀਆਂ ਜਾਂਦੀਆਂ ਆਪਣੀ ਸਰੀਰਕ ਵਰਜਿਸ਼ ਕਰਨ ਲਈ ਖੇਡੀਆਂ ਜਾਂਦੀਆਂ ਪਰ ਸ਼ਹਿਰਾਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਉਹਨਾਂ ਨੂੰ ਜਿਹੜੀ ਤਰਜੀਹ ਦਿੱਤੀ ਜਾਂਦੀ ਹੈ ਉਹ ਤਾਂ ਦਿੱਤੀ ਜਾਂਦੀ ਹੈ ਕਿ ਉਹਦੇ ਵਿੱਚ ਰੁਤਬਾ ਬਣੇ ਸਨਮਾਨ ਬਣੇ ਅਤੇ ਆਪਣਾ ਨਾਮ ਬਣੇ ਇਹਦੇ ਲਈ ਉਹਦੇ ਵਿੱਚ ਉਨਾ ਖੇਡਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਜਿਹੜੀਆਂ ਇੰਟਰਨੈਸ਼ਨਲ ਤੌਰ 'ਤੇ ਮਾਨਤਾ ਪ੍ਰਾਪਤ ਹਨ ਅਤੇ ਪਿੰਡਾਂ ਦੇ ਵਿੱਚ ਬਾਂਦਰ ਕਿੱਲਾ ਸਟੱਪੂ ਆਦਿ ਜਿਹੜੀਆਂ ਖੇਡਾਂ ਉਹ ਖੇਡੀਆਂ ਜਾਂਦੀਆਂ ਅਤੇ ਇਹਦੇ ਨਾਲ ਨਾਲ ਕਬੱਡੀ ਕੁਸ਼ਤੀ ਦੇ ਅਖਾੜੇ ਆਦਿ ਵੀ ਪਿੰਡਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਲਗਾਏ ਜਾਂਦੇ ਆ ਅਤੇ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਟੂਰਨਾਮੈਂਟ ਓ ਕ੍ਰਿਕਟ ਫੁੱਟਬਾਲ ਬੈਡਮਿੰਟਨ ਵਗੈਰਾ ਦੇ ਹੁੰਦੇ ਹਨ ਸੋ ਪਿੰਡਾਂ ਪੇਂਡੂ ਖੇਤਰ 'ਤੇ ਸ਼ਹਿਰੀ ਖੇਤਰਾਂ ਦੇ ਖੇਡਾਂ ਵਿੱਚ ਇਸ ਤਰੀਕੇ ਨਾਲ ਕਾਫ਼ੀ ਅੰਤਰ ਹੈ ਜਿਹੜਾ ਉਹ ਪਾਇਆ ਜਾਂਦਾ